ਭਾਰਤੀ ਸਿੱਖਿਆ ਪ੍ਰਣਾਲੀ ਵਿੱਚ ਬਹੁਤ ਕਮੀਆਂ ਹਨ ਜਿਵੇਂ ਕਿ ਫੰਡਾਂ ਦੀ ਮੈਨੇਜਮੈਂਟ ਨੂੰ ਸਹੀ ਤਰਕ ਨਾਲ ਵਰਤੋਂ ਨਾ ਕਰਨਾ ਕਿਉਂਕਿ ਬੱਚੇ ਤਾਂ ਬਹੁਤ ਪੜ੍ਹਨਾ ਚਾਹੁੰਦੇ ਹਨ ਪਰ ਸਰਕਾਰ ਕੋਲ ਐਨੇ ਫੰਡ ਨਹੀਂ ਹੈ ਕਿ ਉਹ ਹਰ ਇੱਕ ਬੱਚੇ ਨੂੰ ਦੇ ਸਕਣ ਅਤੇ ਉਸ ਲਈ ਸਰਕਾਰ ਨੂੰ ਫੰਡ ਰੇਜ਼ ਕਰਨੇ ਚਾਹੀਦੇ ਹਨ ਅਤੇ ਉਸ ਤੋਂ ਇਲਾਵਾ ਕਈ ਬੱਚਿਆਂ ਦੇ ਮਾਪੇ ਨਹੀਂ ਚਾਹੁੰਦੇ ਕਿ ਉਹ ਪੜ੍ਹਨ ਅਤੇ ਸਰਕਾਰ ਨੂੰ ਇਹ ਜਿਹੇ ਕੈਂਪ ਲਾਉਣੇ ਚਾਹੀਦੇ ਹਨ ਕਿ ਜਿਸ ਨਾਲ ਬੱਚੇ ਪ੍ਰੇਰਿਤ ਹੋਰ ਹੋਰ ਪੜ੍ਹਨ ਲਈ